ਹੈਲੋ ਸਰ ਤੁਸੀਂ ਓਲਾ ਕੰਪਨੀ ਤੋਂ ਬੋਲਦੇ ਪਏ ਜੇ ਅਸੀਂ ਨਾ ਤੁਹਾਡੇ ਕੋਲ ਕੈਬ ਬੁੱਕ ਕਰਵਾਈ ਸੀਗੀ ਪੀ ਬੀ ਵੀਹ ਬਾਰਾਂ ਅਸੀਂ ਨਾ ਦਿੱਲੀ ਜਾਣਾ ਸੀ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਸਾਡਾ ਅਸੀਂ ਤੁਹਾਡੇ ਕੋਲ ਬੁੱਕ ਕਰਵਾਈ ਸੀਗੀ ਪਰ ਸਾਨੂੰ ਨਾ ਹੁਣ ਥੋੜ੍ਹੀ ਸਾਡੇ ਪਰਿਵਾਰ ਮੈਂਬਰ ਵਿੱਚ ਨਾ ਸਾਰੇ ਪਰਿਵਾਰ ਨੇ ਜਾਣਾ ਸੀਗਾ ਪਰਿਵਾਰ ਮੈਂਬਰ ਵਿੱਚ ਕਿਸੇ ਦੀ ਨਾ ਜ਼ਿਆਦਾ ਹੀ ਤਬੀਅਤ ਖਰਾਬ ਹੋ ਗਈ ਆ ਹੁਣ ਅਸੀਂ ਜਾ ਨੀ ਪਾਵਾਂਗੇ ਉਹਨਾਂ ਨੂੰ ਹੋਸਪੀਟਲ ਖੜ੍ਹਨਾ ਪਿਆ ਵਾ ਇਸ ਕਰਕੇ ਸਰ ਹੁਣ ਨਾ ਅਸੀਂ ਤੁਹਾਨੂੰ ਦੋ ਹਜ਼ਾਰ ਪਹਿਲਾਂ ਅਸੀਂ ਤੁਹਾਨੂੰ ਦਿੱਤਾ ਹੋਇਆ ਸੀਗਾ ਭੁਗਤਾਨ ਕੀਤਾ ਹੋਇਆ ਸੀਗਾ ਅਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹ ਜਿਹੜਾ ਦੋ ਹਜ਼ਾਰ ਰੁਪਇਆ ਸਾਡਾ ਉਹ ਸਾਨੂੰ ਤੁਸੀਂ ਵਾਪਿਸ ਕਰ ਦਿਓ ਜਿੱਦਾਂ ਓਲਾ ਵਾਲਟ ਤੋਂ ਤੁਸੀਂ ਜਿੱਦਾਂ ਸਾਡੇ ਫੋਨ 'ਤੇ ਕਰਨਾ ਚਾਹੁੰਦੇ ਹੋ ਗੂਗਲ ਪੇ ਕਰਨਾ ਚਾਹੁੰਦੇ ਹੋ ਜਾਂ ਸਾਨੂੰ ਸਾਨੂੰ ਉੱਦਾਂ ਬੈਂਕ ਅਕਾਊਂਟ 'ਚ ਖਾਤੇ 'ਚ ਪਾਉਣਾ ਚਾਹੁੰਦੇ ਹੋ ਜਿੱਦਾਂ ਵੀ ਚਾਹੁੰਦੇ ਹੋ ਤੁਸੀਂ ਤੁਹਾਡੀ ਮਿਹਰਬਾਨੀ ਹੋਵੇਗੀ ਕਿ ਸਾਡੀ ਉਹ ਦੋ ਹਜ਼ਾਰ ਰੁਪਇਆ ਜਿਹੜਾ ਵਾਪਿਸ ਕੀਤਾ ਜਾਵੇ ਅਤੇ ਜਦੋਂ ਵੀ ਅਸੀਂ ਕਿਤੇ ਵੀ ਜਾਣਾ ਹੋਊਗਾ ਅਸੀਂ ਤੁਹਾਡੀ ਕੈਬ ਜ਼ਰੂਰ ਕਰਾਵਾਂਗੇ ਬਹੁਤ ਧੰਨਵਾਦ ਹੋਊਗਾ ਤੁਹਾਡਾ